ਵੈਰੀ ਗੁੱਡ ਆਫਟਰਨੂਨ ਹਾਂਜੀ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਟ੍ਰੇਨ ਆਉਂਦੀ ਆ ਉਹ ਦਿਨ ਵਿੱਚ ਦੋ ਵਾਰੀ ਆਉਂਦੀ ਆ ਤੁਸੀਂ ਮੈਨੂੰ ਦੱਸੋ ਤੁਸੀਂ ਕਿਹੜੀ ਟ੍ਰੇਨ ਵਿੱਚ ਆਉਣਾ ਸ਼ਤਾਬਦੀ ਐਕਸਪਰੈਸ ਵਿੱਚ ਜਾਂ ਜਰਨਲ ਦੇ ਵਿੱਚ ਸ਼ਤਾਬਦੀ ਏ ਸੀ ਵਿੱਚ ਠੀਕ ਹੈ ਜੀ ਸ਼ਤਾਬਦੀ ਐਕਸਪਰੈਸ ਤੁਹਾਨੂੰ ਸਵੇ ਸਵੇਰੇ ਛੇ ਵਜੇ ਮਿਲੇਗੀ ਜਾਂ ਦੂਸਰੀ ਜਿਹੜੀ ਟ੍ਰੇਨ ਹੈ ਉਹ ਤੁਹਾਨੂੰ ਸ਼ਾਮ ਨੂੰ ਮਿਲੇਗੀ ਠੀਕ ਹੈ ਤੁਸੀਂ ਮੰਡੇ ਦੀ ਬੁੱਕ ਕਰਵਾਉਣੀ ਹੈ ਜਾਂ ਟਿਊਸਡੇ ਦੀ ਟਿਊਸਡੇ ਦੀ ਠੀਕ ਹੈ ਦੋ ਮਿੰਟ ਵੇਟ ਕਰੋ ਮੈਂ ਤੁਹਾਨੂੰ ਹੁਣੀ ਦੇਖ ਕੇ ਦੱਸ ਦਿੰਦੀ ਹਾਂ ਹਾਂ ਹਾਂਜੀ ਜਿਹੜੀ ਤੁਸੀਂ ਅਗਰ ਟਿਊਸਡੇ ਦੀ ਬੁੱਕ ਕਰਵਾਉਗੇ ਤਾਂ ਤੁਹਾਨੂੰ ਮੋਰਨਿੰਗ ਛੇ ਵਜੇ ਠੀਕ ਟਰੇਨ ਮਿਲੇਗੀ ਤੁਹਾਨੂੰ ਹਾਂਜੀ ਤੁਹਾਨੂੰ ਇਹਦੇ ਲਈ ਇੱਕ ਹਜ਼ਾਰ ਰੁਪਇਆ ਦੀ ਇੱਕ ਟਿਕਟ ਮਿਲੇਗੀ ਹਾਂਜੀ ਅਗਰ ਤੁਸੀਂ ਇਹਨੂੰ ਕੈਂਸਲ ਕਰਾਉਣਾ ਤਾਂ ਤੁਹਾਨੂੰ ਪਹਿਲਾਂ ਦੱਸਣਾ ਪਏਗਾ ਮਤਲਬ ਇੱਕ ਘੰਟਾ ਪਹਿਲਾਂ ਤੁਸੀਂ ਦਸ ਸਕਦੇ ਹੋ ਅਤੇ ਤੁਹਾਨੂੰ ਸਾਰੇ ਪੈਸੇ ਰੀਫੰਡ ਨਹੀਂ ਹੋਣਗੇ ਤੁਹਾਨੂੰ ਇਹਦੇ ਵਿੱਚੋਂ ਸੈਵਨਟੀ ਫਾਈਵ ਪਰਸੈਂਟ ਰੀਫੰਡ ਹੋ ਸਕਦਾ ਆ ਆਫਟਰ ਵਨ ਵੀਕ ਤੁਸੀਂ ਉਹਦੇ ਲਈ ਵੀ ਪਹਿਲਾਂ ਬੁੱਕ ਕਰਵਾ ਲਿਓ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਆਪ ਇਵਨਿੰਗ ਟਾਈਮ ਦੀ ਵੀ ਲੈ ਸਕਦੇ ਔਰ ਮੋਰਨਿੰਗ ਟਾਈਮ ਦੀ ਵੀ ਤੁਹਾਨੂੰ ਨਹੀਂ ਅਵੇਲੇਬਲ ਹੋਏਗੀ ਤੁਹਾਨੂੰ ਇਵਨਿੰਗ ਟਾਈਮ ਹੀ ਹੋਏਗੀ ਉਹਦੇ ਲਈ ਵੀ ਸੇਮ ਇਹ ਹਜ਼ਾਰ ਰੁਪਇਆ ਹੀ ਟਿਕਟ ਹੋਏਗੀ ਉਹਦੇ ਵਿੱਚ ਤੁਹਾਨੂੰ ਇੱਕ ਤੁਸੀਂ ਏ ਸੀ ਕਹਿ ਰਹੇ ਹੋ ਅਤੇ ਏ ਏ ਸੀ ਟ੍ਰੇਨ ਹੋਏਗੀ ਤਾਂ ਏ ਸੀ ਤਾਂ ਮਿਲੇਗਾ ਹੀ ਉਹਦੇ ਵਿੱਚ ਤੁਹਾਨੂੰ ਵਨ ਟਾਈਮ ਲੰਚ ਮਿਲੇਗਾ ਹਾਂ ਤੁਸੀਂ ਮੋਰਨਿੰਗ ਟਾਈਮ ਚੱਲ ਰਹੇ ਹੋ ਤਾਂ ਤੁਹਾਨੂੰ ਲੰਚ ਵੀ ਮਿਲੇਗਾ ਔਰ ਡਿਨਰ ਵੀ ਪ੍ਰੋਵਾਈਡ ਹੋਏਗਾ ਜੇਕਰ ਤੁਸੀਂ ਸਲੀਪਿੰਗ ਬੁੱਕ ਕਰਵਾਉਂਦੇ ਹੋੋੋੋੋੋੋੋੋੋੋੋੋੋੋੋੋੋੋ ਤਾਂ ਟਿਕਟ ਲੈਂਦੇ ਹੋ ਅਤੇ ਤਾਂ ਤੁਹਾਨੂੰ ਮਿਲੇਗੀ ਹਾਂਜੀ ਵੋਸ਼ਰੂਮ ਵਗੈਰਾ ਕਲੀਨ ਹੋਣਗੇ ਪਰ ਜੇਕਰ ਤੁਹਾਡਾ ਬੱਚਾ ਸੈਵਨ ਈਅਰਸ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਉਹਦੇ ਲਈ ਕ ਪੂਰੀ ਟਿਕਟ ਲੱਗੇਗੀ ਪੂਰੀ ਲੱਗੇਗੀ ਤਾਂ ਮਤਲਬ ਹਜ਼ਾਰ ਰੁਪਇਆ ਹੀ ਲੱਗੇਗੀ ਹਾਂਜੀ ਜੀ ਹੁਣ ਇਹਦੇ ਵਿੱਚ ਤੁਹਾਨੂੰ ਬਸ ਇਹੀ ਫਸਿਲਿਟੀ ਮਿਲਣਗੀਆਂ ਇਸ ਤੋਂ ਜ਼ਿਆਦਾ ਫਸਿਲਿਟੀ ਨਹੀਂ ਮਿਲ ਸਕਦੀਆਂ ਅਗਰ ਟ੍ਰੇਨ ਲੇਟ ਹੋਈ ਤਾਂ ਤੁਸੀਂ ਸਾਨੂੰ ਤੁਸੀਂ ਐ ਕੋਈ ਓਨਲਾਈਨ ਬੁੱਕ ਕਰਾਓਗੇ ਤਾਂ ਤੁਹਾਨੂੰ ਓਨਲਾਈਨ ਹੀ ਦੱਸ ਦਿੱਤਾ ਜਾਵੇਗਾ ਕਿ ਟ੍ਰੇਨ ਨੂੰ ਕੀ ਹਾਂਜੀ ਡਬਲਯੂ ਡਬਲਯੂ ਡੋਟ ਕੌਮ ਰੇਲਵੇ ਸਟੇਸ਼ਨ ਡੋਟ ਦਿੱਲੀ ਠੀਕ ਹੈ ਜੀ ਹਾਂਜੀ ਬਿਲਕੁਲ ਸਾਨੂੰ ਕਰ ਸਕਦੇ ਐ ਓਕੇ ਜੀ ਵੈਲਕਮ